ਸਿੱਖਿਆ ਦੇ ਮਾਮਲੇ ਵਿੱਚ ਰੂਪਨਗਰ ਰੋਜ਼ਗਾਰ ਅਤੇ ਲੀਡਰਸ਼ਿਪ ਦੇ ਰੂਪ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਨੌਜਵਾਨਾਂ ਦੇ ਲਈ ਬਹੁਤ ਮੌਕੇ ਹਨ ਅਤੇ ਜੇ ਕੋਈ ਨੌਜਵਾਨ ਹੈ ਇਸ ਆਪਣੇ ਇਹ ਸਭ ਚੀਜ਼ ਨੂੰ ਬਣਾਉਣਾ ਚਾਹੁੰਦਾ ਹੈ ਤਾਂ ਕੌਲਜ ਦੇ ਵਿੱਚ ਹੀ ਇਹ ਸਭ ਉਹਨਾਂ ਨੂੰ ਮਿਲ ਜਾਂਦੇ ਹਨ ਅਤੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇੱਥੇ ਰੋਜ਼ਗਾਰ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਕਮ ਹੈ ਜਿਸ ਕਰ ਜਿਸ ਕਰਕੇ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਹੈ ਕਮਾਉਣ ਲਈ ਅਤੇ ਲੀਡਰਸ਼ਿਪ ਦੇ ਮਾਮਲੇ ਵਿੱਚ ਬੱਚਿਆਂ ਦੇ ਕੋਲ ਐਨ ਸੀ ਸੀ ਐਨ ਐਸ ਐਸ ਵੋਲੰਟੀਅਰ ਕੌਲਜ ਦੇ ਵਿੱਚ ਵੋਲੰਟੀਅਰੀ ਹੈ ਜਿਸ ਦੇ ਵਿੱਚ ਬੱਚੇ ਸ਼ਾਮਿਲ ਵੀ ਹੁੰਦੇ ਹਨ ਅਤੇ ਆਪਣੇ ਡਿਸਟ੍ਰਿਕਟ ਦਾ ਨਾਂ ਰੌਸ਼ਨ ਵੀ ਕਰਦੇ ਹਨ ਅਤੇ ਬਹੁਤ ਸਾਰੇ ਸਪੋਰਟਸ ਕਲੱਬ ਵੀ ਹਨ ਜਿਸਦੇ ਜਿਸ ਵਿੱਚ ਨੌਜਵਾਨ ਹਮੇਸ਼ਾ ਭਾਗ ਲੈਂਦੇ ਹਨ ਅਤੇ ਬਹੁਤ ਮੈਡਲਾਂ ਨੈਸ਼ਨਲ ਪੱਧਰ 'ਤੇ ਵੀ ਲੈ ਕੇ ਆਏ ਹੋਏ ਹਨ